ਹਾਂਜੀ ਸਰ ਉਬਰ ਕੈਬ ਤੋਂ ਬੋਲਦੇ ਹੋ ਮੈਂ ਨਾ ਤੁਹਾਡੀ ਕੈਬ ਬੁੱਕ ਕਰਵਾਈ ਸੀ ਅਤੇ ਮੈਂ ਹੁਣ ਕੈਂਸਲ ਕਰਨਾ ਚਾਹੁੰਦੀ ਹਾਂ ਅਤੇ ਮੈਂ ਤੁਹਾਨੂੰ ਪੈਸੇ ਪੇਮੈਂਟ ਵੀ ਕਰ ਬੈਠੀ ਹਾਂ ਅਤੇ ਜੇ ਤੁਸੀਂ ਮੈਨੂੰ ਪੈਸੇ ਵਾਪਸ ਕਰ ਦਿਉ ਤਾਂ ਚਾਹੇ ਗੂਗਲ ਪੇਅ 'ਤੇ ਕਰ ਦਿਉ ਚਾਹੇ ਪੇਅਟੀਐੱਮ ਜਾਂ ਪੇਅ ਫੋਨ 'ਤੇ ਮੇਰੇ ਕੋਲ ਤਿੰਨੇ ਹੈਗੇ ਹੈ ਤਾਂ ਕਿ ਮੇਰੇ ਖਾਤੇ 'ਚ ਆ ਜਾਣ ਕਰ ਸਕ ਕਰ ਦੇਵੋਂਗੇ ਠੀਕ ਹੈ ਜੀ ਠੀਕ